ਹਾਂਜੀ ਸਤਿ ਸ਼੍ਰੀ ਅਕਾਲ ਜੀ ਭੁਪਿੰਦਰ ਸਿੰਘ ਗੱਲ ਕਰ ਰਹੇ ਹੋ ਜੀ ਭੁਪਿੰਦਰ ਸਿੰਘ ਗੱਲ ਕਰ ਹਾਂਜੀ ਸਰ ਕੀ ਹਾਲ ਚਾਲ ਨੇ ਜੀ ਤੁਹਾਡੇ ਸਰ ਮਹਿੰਦਰਾ ਏਜੰਸੀ ਤੋਂ ਗੱਲ ਕਰ ਰਹੇ ਹੋ ਸਰ ਮੈਂ ਨਾ ਇੰਦਰਪ੍ਰੀਤ ਸਿੰਘ ਇੰਦਰਪ੍ਰੀਤ ਸਿੰਘ ਗੱਲ ਕਰ ਰਿਹਾ ਵਿਲੇਜ਼ ਮੋਹਾਲੀ ਤੋਂ ਅਸੀਂ ਨਾ ਮਹਿੰਦਰਾ ਕੰਪਨੀ ਦੀ ਇੱਕ ਨਿਊ ਕਾਰ ਲੈਣੀ ਹੈ ਇਸ ਟਾਈਮ ਤੁਹਾਡੇ ਏਜੰਸੀ 'ਚ ਕਿਹੜੀ ਕਿਹੜੀ ਅ ਕਾਰ ਉਪਲਬਧ ਆ ਤੁਸੀਂ ਕੀ ਜੀ ਓਕੇ ਥਾ ਨਿਊ ਮਾਡਲ ਇਹ ਥਾਰ ਕਿਹੜੇ ਕਿਹੜੇ ਕਲਰ 'ਚ ਖੜ੍ਹੀ ਹੈ ਜੀ ਤੁਹਾਡੇ ਕੋਲ ਜੀ ਜੀ ਓਕੇ ਓਕੇ ਅਤੇ ਸਰ ਇਹ ਕਿੰਨੇ ਕੁ ਟਾਈਮ 'ਚ ਅਰੇਂਜ ਹੋ ਜਾਉਗੀ ਓਕੇ ਅਤੇ ਸਰ ਇਸ ਟਾਈਮ ਮੈਂ ਕਿਹਾ ਵੀ ਸਾਲ ਦਾ ਐਂਡ ਹੋ ਰਿਹਾ ਅਤੇ ਦੀਵਾਲੀ ਲੰਘੀ ਕੋਈ ਔਫਰ ਚੱਲਦਾ ਹੋਣਾ ਕੋਈ ਤੁਹਾਡੇ ਕੋਲ ਠੀਕ ਹੈ ਜੀ ਅਤੇ ਸਟਾਰਟਿੰਗ ਕੀ ਹੈ ਸਟਾਰਟਿੰਗ ਪ੍ਰਾਈਜ਼ ਕੀ ਹੈ ਇਹਨਾਂ ਦਾ ਓਕੇ ਕਾਗਜ਼ ਪੱਤਰ ਸਣੇ ਉਹੀ ਓਕੇ ਠੀਕ ਹੈ ਜੀ ਅਤੇ ਬਲੈਕ ਕਲਰ ਹੀ ਵੈਸੇ ਉੱਦਾਂ ਜੱਚਦਾ ਵਾ ਹਾਂ ਔਨ ਡਿਮਾਂਡ ਬਲੈਕ ਹੀ ਹੈ ਚੱਲੋ ਬਲੈਕ ਹੀ ਕਰ ਦਿਓ ਅਤੇ ਅਤੇ ਕੋਈ ਇਹਨਾਂ ਦੀਆਂ ਮਤਲਬ ਹੈਂਜੀ ਮੈ ਕਿਹਾ ਜੀ ਮੈਂ ਐਦਾਂ ਪੁੱਛ ਰਿਹਾ ਵੀ ਜਿਹੜੇ ਆਪਣੇ ਤੁਹਾਡੇ ਏਜੰਸੀ ਆ ਇਹ ਫਤਿਹਗੜ੍ਹ ਸਾਹਿਬ ਕਿੱਥੇ ਕੁ ਹੋਈ

ਹਾਂ ਓ ਓਕੇ ਓਕੇ ਓਕੇ ਵੈਸੇ ਤਾਂ ਮੈਨੂੰ ਤੁਹਾਡਾ ਨੰਬਰ ਵੈਸੇ ਤਾਂ ਤੁਹਾਡਾ ਨੰਬਰ ਆ ਏ ਗਿਆ ਮੇਰੇ ਕੋਲ ਮੈਂ ਨਾ ਤੁਹਾਨੂੰ ਹਾਂ ਹਾਂਜੀ ਹਾਂਜੀ ਅਤੇ ਆਪਾਂ ਕਦੋਂ ਮਿਲ ਸਕਦੇ ਹਾਂ ਅਤੇ ਕਦੋਂ ਮਿਲ ਸਕਦੇ ਹਾਂ ਆਪਾਂ ਕੱਲ੍ਹ ਦਸ ਵਜੇ ਤੋਂ ਬਾਅਦ ਠੀਕ ਹੈ ਜੀ ਅਤੇ ਚੱਲੋ ਕੱਲ੍ਹ ਨੂੰ ਤੁਹਾਨੂੰ ਦਸ ਵਜੇ ਤੋਂ ਬਾਅਦ ਮਿਲਦੇ ਹਾਂ ਜੀ ਤੁਹਾਨੂੰ ਕੋਲਿੰਗ 'ਤੇ ਹੋਉਗੀ ਠੀਕ ਓਕੇ ਜੀ ਥੈਂਕ ਯੂ